ਹੱਥ ਦੇ ਬਣੇ ਅਤੇ ਰੇਡੀਮੇਡ ਕੱਪੜਿਆਂ ਦੇ ਵਿੱਚ ਬਹੁਤ ਅੰਤਰ ਹੈ ਇਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਡਿਫਰੈਂਸ ਇਹ ਹੈ ਕਿ ਜਦੋਂ ਆਪਾਂ ਰੇਡੀਮੇਡ ਕੱਪੜੇ ਖਰੀਦਦੇ ਹਾਂ ਆਪਾਂ ਨੂੰ ਵਰਾਇਟੀ ਤਾਂ ਬਹੁਤ ਮਿਲ ਜਾਂਦੀ ਹੈ ਪਰ ਬਹੁਤ ਵਾਰੀ ਇਸ ਤਰ੍ਹਾਂ ਦੇਖਿਆ ਜਾਂਦਾ ਕਿ ਆਪਾਂ ਨੂੰ ਆਪਣਾ ਸਾਈਜ਼ ਨਹੀਂ ਮਿਲਦਾ ਜਦੋਂ ਕਿ ਹੈਂਡਮੇਡ ਕੱਪੜਿਆਂ ਦੀ ਗੱਲ ਹੁੰਦੀ ਹੈ ਤਾਂ ਨੀਟਿਡ ਕੱਪੜਿਆਂ ਦੀ ਗੱਲ ਹੁੰਦੀ ਹੈ ਤਾਂ ਉਸ ਨੂੰ ਆਪਾਂ ਆਪਣੇ ਬਾਡੀ ਦੇ ਹਿਸਾਬ ਨਾਲ ਆਪਣੀ ਚੋਇਸ ਦੇ ਹਿਸਾਬ ਨਾਲ ਟਾਈਟ ਜਾਂ ਲੂਜ਼ ਕਰ ਸਕਦੇ ਹਾਂ ਉਸਨੂੰ ਆਪਾਂ ਆਪਣੀ ਲਾਈਕਿੰਗ ਦੇ ਹਿਸਾਬ ਨਾਲ ਕਸਟਮਾਈਜ਼ ਕਰ ਸਕਦੇ ਹਾਂ ਹੈਂਡਮੇਡ ਕੱਪੜਿਆਂ ਦੇ ਵਿੱਚ ਆਪਾਂ ਨੂੰ ਆਪਣੀ ਪਰਸਨਲ ਚੋਇਸ ਅੱਗੇ ਰੱਖ ਕੇ ਉਹਨਾਂ ਨੂੰ ਡਿਜ਼ਾਇਨ ਕਰਨ ਦੀ ਸੁਵਿਧਾ ਹੁੰਦੀ ਹੈ ਬਟ ਰੇਡੀਮੇਡ ਕੱਪੜਿਆਂ ਦੇ ਵਿੱਚ ਕੀ ਹੁੰਦਾ ਕਿ ਆਪਾਂ ਨੂੰ ਇੱਕੋ ਹੀ ਡਿਜ਼ਾਇਨ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਸਾਈਜ਼ ਮਿਲ ਜਾਂਦੇ ਨੇ ਜਿਵੇਂ ਐਕਸਐੱਲ ਐੱਲ ਡਬਲ ਐਕਸਐੱਲ ਪਰ ਉਹਦੇ ਵਿੱਚ ਆਪਾਂ ਨੂੰ ਡਿਜ਼ਾਇਨ ਦੇ ਵਿੱਚ ਕੰਪਰੋਮਾਈਜ਼ ਕਰਨਾ ਪੈਂਦਾ ਹਜੇ ਵੀ ਮੈਂ ਦੇਖਿਆ ਬਹੁਤ ਸਾਰੇ ਲੋਕ ਰੇਡੀਮੇਡ ਦੀ ਬਜਾਏ ਨੀਟਿਡ ਦੇ ਵਿੱਚ ਜਾਂਦੇ ਨੇ ਕਿਉਂਕਿ ਉਹ ਆਪਣੀਆਂ ਡਰੈਸਿਸ ਨੂੰ ਕਸਟਮਾਈਜ਼ ਕਰਵਾਉਂਦੇ ਨੇ ਕਸਟਮਾਈਜ਼ ਦਾ ਮਤਲਬ ਕਿ ਆਪਣੀ ਪਸੰਦ ਦੇ ਹਿਸਾਬ ਨਾਲ ਉਸਨੂੰ ਉਹ ਡਿਜ਼ਾਇਨ ਕਰਵਾਉਂਦੇ ਨੇ ਰੈਡੀਮੇਡ ਕੱਪੜਿਆਂ ਦੇ ਵਿੱਚ ਕੰਪਰੋਮਾਈਜ਼ ਕਰਨਾ ਪੈਂਦਾ ਹਾਂ ਪਰ ਇੱਕ ਗੱਲ ਇੱਥੇ ਧਿਆਨ ਦੇਣ ਯੋਗ ਹੈ ਕਿ ਜਿਹੜੇ ਰੇਡੀਮੇਡ ਕੱਪੜੇ ਹੁੰਦੇ ਨੇ ਉਹ ਆਪਾਂ ਨੂੰ ਥੋੜ੍ਹੇ ਸਸਤੇ ਮਿਲ ਜਾਂਦੇ ਹਨ ਪਰ ਉਹ ਹੀ ਜਦੋਂ ਆਪਾਂ ਡਿਜ਼ਾਇਨ ਕਸਟਮਾਈਜ਼ ਕਰਵਾਉਂਦੇ ਹਾਂ ਤਾਂ ਉਹ ਕੋਸਟਲੀ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਟੇਲਰ ਦੀ ਕੋਸਟ 'ਤੇ ਜੋ ਵੀ ਉਹਦੇ ਉੱਤੇ ਮਟੀਰੀਅਲ ਲੱਗਦਾ ਉਹਦੀ ਕੋਸਟ ਜ਼ਿਆਦਾ ਹੁੰਦੀ ਹੈ ਜਦੋਂ ਕਿ ਰੇਡੀਮੇਡ ਕੱਪੜੇ ਉਹ ਇੱਕ ਡਿਜ਼ਾਇਨ ਬਲਕ ਦੇ ਵਿੱਚ ਨਿਕਲਦਾ ਉਹਦੇ ਕਰਕੇ ਉਸਦੀ ਕੋਸਟ ਘੱਟ ਹੋ ਜਾਂਦੀ ਹੈ ਮੈਂ ਹਮੇਸ਼ਾ ਕਸਟਮਾਈਜ਼ ਕਲੋਥਿੰਗ ਦੇ ਵਿੱਚ ਹੀ ਜਾਂਦੀ ਹਾਂ